ਕੋਵਿਡ ਲੋਕਡਾਊਨ ਦੌਰਾਨ ਜਦੋਂ ਸਕੂਲ ਬੰਦ ਹੋ ਗਏ ਤਾਂ ਫਿਰ ਸਰਕਾਰ ਨੇ ਇੱਕ ਨਵਾਂ ਢੰਗ ਕੱਢਿਆ ਕਿ ਬੱਚਿਆਂ ਨੂੰ ਔਨਲਾਈਨ ਜਾਂ ਮੋਬਾਇਲ ਫੋਨ ਨਾਲ ਪੜ੍ਹਾਈ ਕਰਵਾਈ ਜਾਵੇ ਸੋ ਇੱਕ ਤਾਂ ਵਧੀਆ ਢੰਗ ਸੀਗਾ ਕਿ ਇਹਦੇ ਵਿੱਚ ਅਸੀਂ ਮਤਲਬ ਬੱਚਿਆਂ ਦੇ ਨਾਲ ਟੀਚਰਸ ਜਿਹੜੇ ਕਨੈਕਟਡ ਹੋ ਗਏ ਸੀਗੇ ਬੱਚਿਆਂ ਨੂੰ ਘਰ ਬੈਠਿਆਂ ਨੂੰ ਪੜ੍ਹਾਉਂਦੇ ਸੀ ਕਲਾਸਿਸ ਲੱਗਦੀਆਂ ਸੀਗੀਆਂ ਅਤੇ ਪਰ ਇਹਦਾ ਇੱਕ ਫਾਇਦਾ ਸੀਗਾ ਕਿ ਬੱਚੇ ਆਪਣੀ ਸਟੱਡੀ ਨਾ ਕੰਟੀਨਊ ਕਰ ਸਕੇ ਪਰ ਦ ਦੂਸਰਾ ਨੁਕਸਾਨ ਇਹ ਸੀ ਕਿ ਬੱਚੇ ਸਾਰਾ ਸਾਰਾ ਦਿਨ ਫੋਨ 'ਤੇ ਲੱਗੇ ਰਹਿੰਦੇ ਸੀਗੇ ਜਿਹਦੇ ਨਾਲ ਉਹਨਾਂ ਦੀਆਂ ਅੱਖਾਂ ਦਾ ਜਾਂ ਉਹਨਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਸੀਗਾ ਕਿਉਂਕਿ ਇਹ ਬੜਾ ਸਟਰੈਸੇਬਲ ਜਿਹਾ ਕੰਮ ਸੀਗਾ ਕਿ ਸਾਰਾ ਦਿਨ ਫੋਨ ਯੂਜ਼ ਕਰਨਾ ਦੂਸਰੀ ਗੱਲ ਹੈ ਕਿ ਪੰਜਾਬੀ ਬਹੁਤੇ ਪੰਜਾਬੀ ਘਰਾਂ ਦੇ ਵਿੱਚ ਫੋਨ ਪੇਰੈਂਟਸ ਕੋਲ ਹੁੰਦਾ ਸੀ ਉਹਨਾਂ ਨੇ ਆਪਣੇ ਕੰਮਕਾਰ ਵੀ ਕਰਨੇ ਹੁੰਦੇ ਸੀਗੇ ਅਤੇ ਬੱਚਿਆਂ ਨੂੰ ਫੋਨ ਦੇਣਾ ਅਤੇ ਉਹ ਵੀ ਮਤਲਬ ਥੋੜ੍ਹਾ ਸਫਰ ਕੀਤਾ ਪੇਰੈਂਟਸ ਨੇ ਵੀ ਇਹ ਕਹਿ ਲਓ ਹੈ ਨਾ ਅਤੇ ਇਸ ਤਰਾਂ ਮਤਲਬ ਦੋ ਹੀ ਚੀਜ਼ਾਂ ਸੀਗੀਆਂ ਕਿ ਇੱਦਾਂ ਫਾਇਦਾ ਵੀ ਹੋਇਆ ਲਾਕਡਾਊਨ ਦੇ ਵਿੱਚ ਮੋਬਾਈਲ ਫੋਨ ਨਾਲ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਅਤੇ ਬੱਚਿਆਂ ਦਾ ਨੁਕਸਾਨ ਵੀ ਹੋਇਆ ਕਿਉਂਕਿ ਉਹ ਪੜ੍ਹਾਈ ਦੇ ਨਾਲ ਨਾਲ ਹੋਰ ਚੀਜ਼ਾਂ ਵੀ ਐਕਸਪਲੋਰ ਕਰਨ ਲੱਗ ਗਏ ਫੋਨ ਦੇ ਵਿੱਚੋਂ ਹੋਰ ਆਈ ਮਤਲਬ ਚੀਜ਼ਾਂ ਦੇਖਣ ਲੱਗ ਗਏ ਜਿਹੜੀਆਂ ਕਿ ਉਹਨਾਂ ਲਈ ਨਹੀਂ ਸੀਗੀਆਂ ਬਣੀਆਂ ਹੋਈਆਂ ਸੋ ਦੋਨੇ ਹੀ ਚੀਜ਼ਾਂ ਸੀਗੀਆਂ ਇਹਦਾ ਫਾਇਦਾ ਵੀ ਸੀ ਨੁਕਸਾਨ ਵੀ ਸੀ